ਜਿਹੜੇ ਲੋਕ ਹਿੰਦੀ ਭਾਸ਼ਾ ਨੂੰ ਚੰਗੀ ਤਰ੍ਹਾਂ ਸਮਝ ਲੈਂਦੇ ਹਨ ਉਹ ਪੰਜਾਬੀ ਭਾਸ਼ਾ ਨੂੰ ਵੀ ਚੰਗੀ ਤਰ੍ਹਾਂ ਸਮਝ ਸਕਦੇ ਹਨ ਪੰਜਾਬੀ ਭਾਸ਼ਾ ਮਾਂ ਬੋਲੀ ਪੰਜਾਬੀ ਜਿਹੜੀ ਭਾਸ਼ਾ ਹੈ ਉਹ ਬਹੁਤ ਹੀ ਸੁਖਾਲੀ ਹੈ ਅਤੇ ਪੂਰੇ ਭਾਰਤ ਤੋਂ ਲੈ ਕੇ ਅਦਰ ਕੰਟਰੀ ਦੇ ਵਿੱਚ ਵੀ ਬੋਲੀ ਜ ਜਾਣ ਵਾਲੀ ਭਾਸ਼ਾ ਹੈ ਜਿਸਦੇ ਵਿੱਚ ਸਾਡਾ ਪੰਜਾਬੀ ਸੱਭਿਆਚਾਰਕ ਕਲਚਰ ਜਿੱਦਾਂ ਕਿ ਪੰਜਾਬ ਦੇ ਵਿੱਚ ਜੋ ਚੀਜ਼ ਮਸ਼ਹੂਰ ਹਨ ਫੁਲਕਾਰੀ ਪੰਜਾਬੀ ਜੁੱਤੀ ਪਟਿਆਲਾ ਸ਼ਾਹੀ ਸਲਵਾਰ ਪੰਜਾਬੀ ਸੂਟ ਪਟਿਆਲਾ ਸ਼ਾਹੀ ਪੱਗ ਇਹ ਪੂਰੇ ਭਾਰਤ ਤੋਂ ਲੈ ਕੇ ਬਾਹਰ ਵੀ ਬਹੁਤ ਮਸ਼ਹੂਰ ਹਨ ਲੋਕ ਇਸਨੂੰ ਬੜੇ ਕੋਈ ਵੀ ਫੈਸਟੀਵਲ ਹੈ ਤੀਜ਼ ਤਿਉਹਾਰ ਹੈ ਇਸਦੇ ਵਿੱਚ ਇਹ ਲਿਬਾਸ ਪਾ ਕੇ ਬਹੁਤ ਵਧੀਆ ਤਰੀਕੇ ਨਾਲ ਮਨਾਉਂਦੇ ਹਨ ਅਤੇ ਇਸ ਦੇ ਨਾਲ ਜੁੜਦੇ ਹਨ ਜਿੱਦਾਂ ਜੇ ਆਪਾਂ ਗੱਲ ਕਰੀਏ ਸਿੰਗਿੰਗ ਦੇ ਖੇਤਰ ਦੇ ਵਿੱਚ ਤਾਂ ਇਸ ਦੇ ਵਿੱਚ ਬੜੇ ਗੁਲਾਮ ਅਲੀ ਖਾਂ ਸਾਹਿਬ ਗੁਰਦਾਸ ਮਾਨ ਜੀ ਸਤਿੰਦਰ ਸਰਤਾਜ ਕੁਲਦੀਪ ਮਾਣਕ ਹੰਸਰਾਜ ਹੰਸ ਅਤੇ ਮਸ਼ਹੂਰ ਤਬਲਾ ਵਾਦਕ ਜ਼ਾਕਿਰ ਹੁਸੈਨ ਸਾਹਿਬ ਨੇ ਪੰਜਾਬ ਦੇ ਸੱਭਿਆਚਾਰ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ ਹੈ